ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਔਰ ਖੇਤਾਂ ਵਿੱਚ ਬਹੁਤ ਹੀ ਤਰ੍ਹਾਂ ਦੇ ਕੀੜੇ ਮਕੌੜੇ ਜ਼ਮੀਨ ਉੱਤੇ ਤੁਰੇ ਫਿਰਦੇ ਹਨ ਔਰ ਕਦੇ ਨਾ ਕਦੇ ਕਿਸੇ ਨਾ ਕਿਸੇ ਇਨਸਾਨ ਦੇ ਡੰਗ ਮਾਰ ਦਿੰਦੇ ਹਨ ਇਨ੍ਹਾਂ ਕੀੜਿਆਂ ਦੇ ਡੰਗ ਦੇ ਘਰੇਲੂ ਉਪਚਾਰ ਲਈ ਅਸੀਂ ਜੇਕਰ ਕਿਤੇ ਮਧੂਮੱਖੀ ਕਿਸੇ ਦੇ ਡੰਗ ਮਾਰ ਦਿੰਦੀ ਹੈ ਉਸ ਵਾਸਤੇ ਅਸੀਂ ਮੌਕੇ ਉੱਤੇ ਲੋਹੇ ਦੀ ਕੋਈ ਵੀ ਚੀਜ਼ ਜਾਂ ਜਿਵੇਂ ਕਿ ਕੜਾ ਜਾਂ ਕੋਈ ਚਾਬੀ ਉਸ ਨੂੰ ਉਸ ਡੰਗ ਵਾਲੀ ਜਗ੍ਹਾ ਉੱਤੇ ਰਕੜਦੇ ਹਾਂ ਔਰ ਹੋ ਸਕੇ ਤਾਂ ਉਸ ਉੱਪਰ ਮਿੱਟੀ ਦਾ ਤੇਲ ਔਰ ਪੈਟਰੋਲ ਜਾਂ ਡੀਜ਼ਲ ਦਾ ਤੂੰਬਾਂ ਭਰ ਕੇ ਲਗਾਇਆ ਜਾਂਦਾ ਹੈ ਇਸ ਤਰ੍ਹਾਂ ਹੋਰ ਕਈ ਤਰ੍ਹਾਂ ਦੇ ਕੀੜੇ ਮਕੌੜੇ ਦੇ ਡੰਗ ਵਾਸਤੇ ਵੀ ਇਹੋ ਹੀ ਨੁਕਤਾ ਵਰਤਿਆ ਜਾਂਦਾ ਹੈ ਸਾਡਾ ਪਿੰਡ ਸ਼ਹਿਰ ਤੋਂ ਕੁਝ ਦੂਰ ਹੋਣ ਕਰਕੇ ਕੋਈ ਡਾਕਟਰੀ ਸਹੂਲਤ ਨਹੀਂ ਹੈ ਇਸ ਲਈ ਅਸੀਂ ਘਰੇਲੂ ਉਪਚਾਰ ਕਰਕੇ ਹੀ ਇਹਨਾਂ ਕੀੜੇ ਮਕੌੜਿਆਂ ਦੇ ਢੰਗ ਤੋਂ ਬਚ ਸਕਦੇ ਹਾਂ ਹੋਰ ਵੀ ਕਈ ਤਰ੍ਹਾਂ ਦੇ ਕੀੜੇ ਮਕੌੜੇ ਜੋ ਲੜਦੇ ਹਨ ਉਹਨਾਂ ਵਾਸਤੇ ਇਹ ਹੀ ਤਰੀਕਾ ਵਰਤਿਆ ਜਾ ਸਕਦਾ ਹੈ